ਭਾਰਤ ਦੀ ਆਜ਼ਾਦੀ ਦੀ ਲਹਿਰ ਜਾਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਭਾਰਤ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਇਸ ਲਹਿਰ ਵਿੱਚ ਸੈਂਕੜਿਆਂ ਹਜ਼ਾਰਾਂ ਨੇ ਆਪਣੀ ਜਾਨ ਗਵਾਈ ਹਜ਼ਾਰਾਂ ਜਖ਼ਮੀ ਹੋਏ ਹਜ਼ਾਰਾਂ ਜੇਲ੍ਹ ਗਏ ਹਜ਼ਾਰਾਂ ਨੇ ਆਪਣੇ ਪੁੱਤ ਵਾਰੇ ਹਜ਼ਾਰਾਂ ਨੇ ਆਪਣੇ ਸੁਹਾਗ ਉਜਾੜੇ ਹਜ਼ਾਰਾਂ ਦੇ ਘਰ ਉਜੜੇ ਇਹਨਾਂ ਆਜ਼ਾਦੀ ਦੀ ਲਹਿਰ ਵਿੱਚ ਬਹੁਤ ਸਾਰੇ ਨੇਤਾਵਾਂ ਬਹੁਤ ਵੱਡੀਆਂ ਵੱਡੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ ਸਭ ਤੋਂ ਪਹਿਲਾਂ ਜੇ ਗੱਲ ਅਸੀਂ ਕਰ ਸਕਦੇ ਹਾਂ ਤਾਂ ਮਹਾਤਮਾ ਗਾਂਧੀ ਦੀ ਕੀ ਉਹਨਾਂ ਨੇ ਭਾਰਤ ਦੇ ਨੋਨ ਵਾਇਲੈਂਸ ਮੂਵਮੈਂਟ ਚਲਾਇਆ ਜਿਹਨੂੰ ਆਪਾਂ ਕਹਿ ਦਈਏ ਕਿ ਬਗੈਰ ਹੱਥ ਚੁੱਕੇ ਆਪਾਂ ਆਪਣੀ ਸ਼ਾਂਤੀ ਨਾਲ ਆਪਣੀ ਆਜ਼ਾਦੀ ਲੈਣੀ ਹੈ ਉਹਨਾਂ ਨੇ ਕਈ ਇਹੋ ਜਿਹੇ ਮੂਵਮੈਂਟਸ ਚਲਾਏ ਉਹਨਾਂ ਨੇ ਨਮਕ ਦਾ ਕਾਨੂੰਨ ਤੋੜਿਆ ਉਹ ਵੀ ਉਹਨਾਂ ਨੇ ਬਗੈਰ ਹੱਥ ਚੁੱਕੇ ਜਾਂ ਬਗੈਰ ਹਿੰਸਾ ਦੀ ਵਰਤੋਂ ਤੋਂ ਉਹ ਨਮਕ ਦਾ ਕਾਨੂੰਨ ਤੋੜਿਆ ਉਹਨਾਂ ਨੂੰ ਬਹੁਤ ਵਾਰੀ ਜੇਲ੍ਹ ਵੀ ਜਾਣਾ ਪਿਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਭਗਤ ਸਿੰਘ ਦੀ ਭਗਤ ਸਿੰਘ ਮਹਾਤਮਾ ਗਾਂਧੀ ਤੋਂ ਬਿਲਕੁਲ ਉਲਟ ਸੀ ਭਗਤ ਸਿੰਘ ਹਿੰਸਾ ਵਿੱਚ ਕਦਮ ਰੱਖਦਾ ਸੀ ਭਗਤ ਸਿੰਘ ਹਿੰਸਾਵਾਦੀ ਸੋਚ ਰੱਖਦਾ ਸੀ ਉਸਨੂੰ ਲੱਗਦਾ ਸੀ ਕਿ ਬਗੈਰਾ ਹਿੰਸਾ ਤੋਂ ਆਜ਼ਾਦੀ ਨਹੀਂ ਆ ਸਕਦੀ ਇਸ ਕਰਕੇ ਉਸਨੇ ਉੱਨੀ ਸੌ ਉਨੱਤੀ ਵਿੱਚ ਅਸੈਂਬਲੀ ਵਿੱਚ ਬੰਬ ਸੁੱਟ ਕੇ ਆਪਣੇ ਆਪ ਨੂੰ ਆਤਮ ਗ੍ਰਿਫਤਾਰ ਕਰਵਾਇਆ ਅਤੇ ਇਕੱਤੀ ਮਾਰਚ ਉੱਨੀ ਸੌ ਇਕੱਤੀ ਨੂੰ ਉਸ ਨੂੰ ਫਾਂਸੀ ਮਿਲ ਗਈ ਇਹ ਜੋ ਫਾਂਸੀ ਸੀ ਇਹ ਮਹਾਤਮਾ ਗਾਂਧੀ ਰੁਕਵਾ ਸਕਦੇ ਸਨ ਪਰ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਹਿੰਸਾ ਤੋਂ ਪਰੇ ਹਾਂ ਇਸ ਲਈ ਉਹਨਾਂ ਦਾ ਜਿਹੜਾ ਸਮਝੌਤਾ ਹੋਇਆ ਸੀ ਗਾਂਧੀ ਇਰਵਿਨ ਪੈਕਟ ਉਹਨਾਂ ਵਿੱਚ ਉਹਨਾਂ ਨੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਨੂੰ ਹਾਮੀ ਭਰ ਦਿੱਤੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਸੁਭਾਸ਼ ਚੰਦਰ ਬੋਸ ਦੀ ਉਹ ਇੱਕ ਬਹੁਤ ਹੀ ਮਹਾਨ ਯੋਧਾ ਕ੍ਰਾਂਤੀਕਾਰੀ ਸਨ ਜਿਹਨਾਂ ਦਾ ਜਨਮ ਕਲਕੱਤੇ ਵਿੱਚ ਹੋਇਆ ਉਹ ਪਹਿਲਾਂ ਕਾਂਗਰਸ ਵਿੱਚ ਹੀ ਸਨ ਪਰ ਬਾਅਦ ਵਿੱਚ ਉਹਨਾਂ ਨੂੰ ਕਿਸੇ ਕਾਰਨਾਂ ਕਰਕੇ ਕੱਢ ਦਿੱਤਾ ਗਿਆ ਜਾਂ ਉਹਨਾਂ ਨੇ ਖੁਦ ਛੱਡ ਦਿੱਤੀ ਉਹਨਾਂ ਨੇ ਆਪਣੀ ਖੁਦ ਦੀ ਫੌਜ ਬਣਾਈ ਜੋ ਕਿ ਅੰਗਰੇਜ਼ਾਂ ਨਾਲ ਈਸਟ ਇੰਡੀਆ ਕੰਪਨੀ ਨਾਲ ਲੜਦੀ ਉਸ ਦਾ ਨਾਂ ਸੀਗਾ ਆਜ਼ਾਦ ਹਿੰਦ ਫੌਜ ਉਹਨਾਂ ਨੇ ਉਸ ਫੌਜ ਨੇ ਭਾਰਤ ਨੂੰ ਬਹੁਤ ਸਾਰੇ ਯੁੱਧ ਦਿੱਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਹੋਰ ਬਹੁਤ ਸਾਰੇ ਮਹਾਨ ਸ਼ਖਸ਼ੀਅਤਾਂ ਜਿਵੇਂ ਚੰਦਰ ਸ਼ੇਖਰ ਆਜ਼ਾਦ ਜਾਂ ਅਸੀਂ ਇੱਕ ਨਾਮ ਲਈਏ ਪੰਡਿਤ ਜਵਾਹਰ ਲਾਲ ਨਹਿਰੂ ਸਰੋਜਨੀ ਨਾਇਡੂ ਆਦਿ